ਹਾਂ ਮੈਂ ਫੇਸਬੁੱਕ ਟਵਿੱਟਰ ਜਾਂ ਇੰਸਟਾਗਰਾਮ ਵਗੈਰਾ ਸੋਸ਼ਲ ਮੀਡੀਆ ਐਪ ਪਲੇਟਫਾਰਮ ਬਹੁਤ ਯੂਜ਼ ਕਰਦਾ ਹਾਂ ਮੈਨੂੰ ਇਹਨਾਂ ਨੂੰ ਵਰਤੋਂ ਵਿੱਚ ਬਹੁਤ ਮਜ਼ਾ ਆਉਂਦਾ ਹੈ ਨਵੀਂ ਨਵੀਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਹਨ ਨਵੇਂ ਨਵੇਂ ਲੋਕ ਮਿਲਦੇ ਹਨ ਜਿਹਨਾਂ ਨਾਲ ਆਪਾਂ ਗੱਲਾਂ ਬਾਤਾਂ ਮਾਰ ਸਕਦੇ ਹਾਂ ਜਿਹਨਾਂ ਨੂੰ ਆਪਾਂ ਜਾਣਦੇ ਵੀ ਨਹੀਂ ਆ ਇਸ ਨਾਲ ਆਪਾਂ ਪੰਜਾਬ ਵਿੱਚ ਬੈਠੇ ਬੈਠੇ ਚੰਡੀਗੜ੍ਹ ਜਾਂ ਲੁਧਿਆਣੇ ਦੇ ਲੋਕਾਂ ਨਾਲ ਵੀ ਗੱਲਾਂ ਮਾਰ ਸਕਦੇ ਹਾਂ ਮੇਰੇ ਬਥੇਰੇ ਫਰੈਂਡ ਵੈਸੇ ਐਸੇ ਇੰਸਟਾਗਰਾਮ ਕਰ ਕੇ ਹੀ ਬਣੇ ਹਨ ਮੈਨੂੰ ਇੰਸਟਾਗਰਾਮ ਯੂਜ ਵਰਤੋਂ ਕਰਨ ਵਿੱਚ ਬਹੁਤ ਮਜ਼ਾ ਆਉਂਦਾ ਹੈ ਮੇਰੇ ਪਸੰਦ ਵਿੱਚ ਚੀਜ਼ ਇਹ ਕਿ ਮੈਂ ਆਪਣੇ ਪਸੰਦੀਦਾ ਐਕਟਰਾਂ ਕ੍ਰਿਕਟਰਾਂ ਨੂੰ ਵੇਖ ਸਕਦਾ ਹਾਂ ਉਹਨਾਂ ਦੀ ਪੋਸਟਾਂ ਵੇਖ ਸਕਦਾ ਹਾਂ ਅਤੇ ਨਾਪਸੰਦ ਚੀਜ਼ ਇਹ ਹੈ ਕਿ ਅੱਜ ਇਸ ਉੱਤੇ ਅੱਜ ਕੱਲ੍ਹ ਕੁੜੀਆਂ ਨੇ ਬਹੁਤ ਗੰਦ ਮਚਾ ਰੱਖਿਆ ਹੈ ਆਪਣੀ ਅੱਧ ਨੰਗੀਆਂ ਫੋਟੋਆਂ ਪਾਉਂਦੇ ਹਨ ਜੋ ਕਿ ਬਹੁਤ ਗਲਤ ਹੈ ਬਾਕੀ ਜਿਹੜੀ ਸਹੀ ਵਰਤੋਂ ਕੀਤੀ ਲੋਕ ਉਸ ਤੋਂ ਅੱਜ ਕੱਲ੍ਹ ਪੈਸਾ ਵੀ ਬਹੁਤ ਕਮਾ ਰਹੇ ਹਨ ਜਿਵੇਂ ਕਿ ਆਪਣੀ ਵੀਡੀਓਜ ਪਾ ਕੇ ਰੀਲਸ ਪਾ ਕੇ ਜਿਸ ਕਰਕੇ ਉਹਨਾਂ ਦਾ ਰੁਜ਼ਗਾਰ ਵੀ ਵਧਿਆ ਹੈ ਅਤੇ ਘਰ ਵਿੱਚ ਖਾਣਾ ਪਾਣੀ ਵੀ ਆ ਰਿਹਾ ਹੈ ਇਸ ਨੂੰ ਅਗਰ ਤੁਸੀਂ ਸਹੀ ਦਿਸ਼ਾ ਵਿੱਚ ਵਰਤੋਂ ਤਾਂ ਬਹੁਤ ਹੀ ਵਧੀਆ ਹੈ ਅਗਰ ਗਲਤ ਵਿੱਚ ਵਰਤੋਂ ਤਾਂ ਇਸ ਦੇ ਬਹੁਤ ਜ਼ਿਆਦਾ ਨੁਕਸਾਨ ਹਨ ਵੈਸੇ ਵੇਖਿਆ ਜਾਏ ਤਾਂ ਇਸ ਨਾਲ ਰੁਜ਼ਗਾਰ ਵਧਿਆ ਹੈ ਅਤੇ ਵਧੀਆ ਚੀਜ਼ ਹੈ ਬਾਕੀ ਮੈਂ ਤਾਂ ਇਸ ਨੂੰ ਮਨੋਰੰਜਨ ਵਾਸਤੇ ਹੀ ਵਰਤਦਾ ਹਾਂ ਅਤੇ ਦਿਨ ਵਿੱਚ ਘੱਟ ਤੋਂ ਘੱਟ ਇੱਕ ਜਾਂ ਡੇਢ ਘੰਟਾ ਹੀ ਵਰਤਦਾ ਹਾਂ ਡੇਢ ਘੰਟਾ ਇੰਸਟਾਗਰਾਮ ਡੇਢ ਘੰਟਾ ਟਵਿੱਟਰ ਕੁੱਲ ਮਿਲਾ ਕੇ ਤਿੰਨ ਘੰਟੇ ਜਦੋਂ ਵੀ ਮੈਨੂੰ ਦਿਮਾਗ ਖ਼ਰਾਬ ਮੇਰਾ ਹੁੰਦਾ ਜਾਂ ਮੈਨੂੰ ਟੈਂਸ਼ਨ ਹੁੰਦੀ ਹੈ ਤਾਂ ਮੈਂ ਇਸ ਦੀ ਵਰਤੋਂ ਕਰਦਾ ਹਾਂ ਵੈਸੇ ਬਥੇਰੇ ਲੋਕ ਇਸ ਨੂੰ ਅੱਜ ਕੱਲ੍ਹ ਟਾਈਮ ਵੇਸਟ ਵੀ ਕਰਦੇ ਹਨ ਆਪਣਾ ਮਤਲਬ ਕਿ ਪੂਰਾ ਪੂਰਾ ਦਿਨ ਇਸ 'ਤੇ ਲੱਗੇ ਰਹਿੰਦੇ ਹਨ ਤਾਂ ਕੁਛ ਪੜ੍ਹ ਲਿਖ ਨਹੀਂ ਪਾਉਂਦੇ ਜਦੋਂ ਉਹਨਾਂ ਨੂੰ ਪੜ੍ਹਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਗੁੱਸਾ ਆਉਂਦਾ ਹੈ ਤਾਂ ਅੱਗੋਂ ਕਹਿੰਦੇ ਹਨ ਅਸੀਂ ਪੜ੍ਹ ਲਾਂਗੇ ਬਟ ਪੜ੍ਹਦੇ ਨਹੀਂ ਉਹ 'ਚ ਬਸ ਇਸ 'ਤੇ ਹੀ ਲੱਗੇ ਰਹਿੰਦੇ ਹਨ ਬਾਕੀ ਇਸ ਦੀ ਵਰਤੋਂ ਕਰੋ ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਖ਼ਬਰਾਂ ਅਤੇ ਨਵੀਂ ਜਾਣਕਾਰੀ ਵੀ ਮਿਲੇਗੀ ਬਟ ਪਰ ਉਹ ਹੀ ਹੈ ਕਿ ਇੱਕ ਸਮੇਂ ਤੱਕ ਕਰੋ ਵੱਧ ਨਾ